ਹਾਂਜੀ ਆਮ ਤੌਰ 'ਤੇ ਮੈਂ ਪੂਰੀ ਕਿਤਾਬ ਇੱਕ ਘੰਟੇ ਵਿੱਚ ਪੜ੍ਹ ਸਕਦੀ ਹਾਂ ਪਰ ਮੈਨੂੰ ਕਿਤਾਬ ਖੁੱਲ੍ਹੇ ਮਾਹੌਲ ਵਿੱਚ ਪੜ੍ਹਨਾ ਬਹੁਤ ਪਸੰਦ ਹੈ ਇਸ ਲਈ ਮੈਂ ਕਿਤਾਬ ਆਪਣੀ ਛੱਤ 'ਤੇ ਜਾ ਕੇ ਪੜ੍ਹਦੀ ਹਾਂ ਜਿੱਥੇ ਠੰਡੀ ਠੰਡੀ ਹਵਾ ਚੱਲਦੀ ਹੋਵੇ ਅਤੇ ਧਿਆਨ ਇਕਦਮ ਕਿਤਾਬ ਦੇ ਵਿੱਚ ਲੱਗਿਆ ਰਹਿੰਦਾ ਹੈ ਕਿਤਾਬ ਚਾਹੇ ਚੰਗੀ ਹੋ ਹੋਵੇ ਜਾਂ ਥੋੜ੍ਹੀ ਜਿਹੀ ਉਦਾਸ ਉਦਾਸ ਟੀਚਰ ਦੀ ਹੋਵੇ ਪਰ ਅਗਰ ਮੈਨੂੰ ਖੁੱਲ੍ਹਾ ਔਰ ਤਾਜ਼ਾ ਮਾਹੌਲ ਮਿਲੇ ਤਾਂ ਮੈਂ ਪੂਰੀ ਕਿਤਾਬ ਇੱਕ ਘੰਟੇ ਵਿੱਚ ਪੜ੍ਹ ਲੈਂਦੀ ਹਾਂ ਅਤੇ ਮੈਂ ਲਗਾਤਾਰ ਕਿਤਾਬ ਪੜ੍ਹਦੀ ਰਹਿੰਦੀ ਹਾਂ ਚਾਹੇ ਮੈਨੂੰ ਕੋਈ ਵੀ ਬੁਲਾਉਂਦਾ ਰਹੇ ਮੈਨੂੰ ਹੋਸ਼ ਨਹੀਂ ਰਹਿੰਦੀ ਹੈ ਕਿਤਾਬ ਪੜ੍ਹਦੇ ਸਮੇਂ ਮੈਂ ਪੂਰੀ ਤਰ੍ਹਾਂ ਕਿਤਾਬ ਵਿੱਚ ਖੋ ਜਾਂਦੀ ਹਾਂ ਮੈਨੂੰ ਕਿਤਾਬ ਪੜ੍ਹਨਾ ਬਹੁਤ ਜ਼ਿਆਦਾ ਪਸੰਦ ਹੈ ਮੈਂ ਬਹੁਤ ਪ੍ਰਸਿੱਧ ਲੇਖਕਾਂ ਦੀ ਕਿਤਾਬ ਪੜ੍ਹੀ ਹੈ ਅਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਵੀ ਹੈ